ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ

ਇਹ ਇਹ ਸਰ ਰਾਤ ਨੂੰ ਜਾਂਦੀ ਆ ਜੀ ਦਸ ਗਿਆ ਦਸ ਕੁ ਵਜੇ ਜਾਂਦੀ ਆ ਜੀ ਇਹ ਰੋਪੜ ਰੋਪੜ ਤੋਂ ਜੀ

ਹਾਂਜੀ ਇਹਦਾ ਜਿਹੜਾ ਪ ਪੇਸੈਂਜਰ ਦਾ ਹੁੰਦਾ ਜੀ ਪੈਸੰਜਰ ਦਾ ਅੱਠ ਕੁ ਸੌ ਰੁਪਇਆ ਜੀ ਹਾਂਜੀ ਜਿਹੜੀ ਦੂਜੀ ਆ ਜੀ ਉਹ ਇੱਕ ਏ ਸੀ ਵਾਲੀ ਆ ਜੀ ਉਹਦਾ ਪੰਦਰਾਂ ਸੌ ਹੈ ਜੀ ਜਿਹੜੀ ਸਲਿੱਪ ਸਲਿੱਪਰ ਵਾਲੀ ਦਾ ਹਜ਼ਾਰ ਆ ਜੀ

ਨਹੀਂ ਹੋਰ ਵੀ ਇਹਦੇ ਵਿੱਚ ਤੁਹਾਨੂੰ ਜਿੱਦਾਂ ਹੁਣ ਪੇਸੈਜਰ ਵਾਲੀ ਆ ਇਹਦੇ 'ਚ ਤੁਹਾਨੂੰ ਟਾਈਮ ਥੋੜ੍ਹਾ ਜ਼ਿਆਦਾ ਲੱਗਦਾ ਜੀ ਇਹ ਰੁਕ ਰੁਕ ਕੇ ਜਾਂਦੀ ਆ ਜੀ ਅਤੇ ਜਿਹੜੀ ਸੁਪਰਫਾਸਟ ਆ ਉਹਦਾ ਕਿਰਾਇਆ ਜ਼ਿਆਦਾ ਜੀ ਉਹਦਾ ਪੱਚੀ ਸੌ ਆ ਜੀ ਹਾਂਜੀ ਉਹ ਚਾਰ ਘੰਟੇ 'ਚ ਹੀ ਪਹੁੰਚਾ ਦਿੰਦੀ ਆ ਜੀ ਹਾਂਜੀ ਹਾਂਜੀ ਉਹ ਸਵੇਰੇ ਗਿਆਰਾਂ ਕੁ ਵਜੇ ਆ ਜੀ ਉੱਧਰੋਂ ਜੀ ਇੱਧਰ ਨੂੰ

ਹਾਂਜੀ ਹਾਂਜੀ ਰੇਟ ਉਹੀ ਆ ਜੀ ਦੋਨਾਂ ਦਾ

ਉਹ ਵਿੱਚ ਹੀ ਹੁੰਦਾ ਜੀ ਉਹ ਕਿਰਾਏ ਦੇ ਵਿੱਚ ਹੀ ਆਪਾਂ ਕਰ ਲੈਂਦੇ ਜੀ ਉਹ ਜ ਹਾਂਜੀ ਸੁਪਰਫਾਸਟ ਦੇ ਵਿੱਚ ਹੀ ਆ ਜਿਹੜਾ ਏ ਸੀ ਵਾਲੀ ਦਾ ਜੀ

ਹਾਂਜੀ ਹਾਂਜੀ ਸਹੀ ਆ ਜੀ ਇਹਦੀ ਪਹਿਲਾਂ ਹੀ ਬੁਕਿੰਗ ਕਰਾ ਲਿਓ ਨਹੀਂ ਫੇਰ ਉੱਦਾਂ ਸੀਟ ਮਿਲਦੀ ਨਹੀਂ ਨਾ ਹੈਗੀ ਆ ਜੀ ਫੇਰ ਹਾਂਜੀ ਉਹ ਫਿਰ ਕਨਫਰਮ ਨਹੀਂ ਹੁੰਦੀ ਹੈਗੀ ਹੈ ਹਾਂਜੀ ਘੱਟੋਂ ਘੱਟ ਹਫਤਾ ਪਹਿਲਾਂ ਤਾਂ ਕਰਾ ਲਿਓ ਜੀ ਤੁਸੀਂ ਹਾਂਜੀ ਉਹ ਫਿਰ ਟਾਈਮ ਨਾਲ ਹੋ ਜਾਂਦੀ ਆ ਨਾ ਕਨਫਰਮ ਜੀ ਉਹ

ਹਾਂਜੀ ਹਾਂਜੀ ਹਫਤਾ ਪਹਿਲਾਂ ਬੁੱਕ ਕਰਾ ਲਿਓ ਜੀ

ਸਤਿ ਸ਼੍ਰੀ ਅਕਾਲ ਜੀ